ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਤੁਸੀਂ 'ਚ ਆਏ ਹੋ ਆਪਾਂ ਮਿਲੇ ਵੀ ਸੀ ਕੋਲਜ ਵਿੱਚ ਹੈ ਨਾ ਸਾਰੇ ਮੈਂ ਤਾਂ ਦੱਸਿਆ ਸੀ ਠੀਕ ਹੈ ਜੀ ਠੀਕ ਹੈ ਜੀ ਓਕੇ ਓਕੇ ਓਕੇ ਚਲੋ ਮੈਂ ਦੱਸ ਦਿੰਦਾ ਅਸਲ 'ਚ ਕੀ ਹੈ ਕਿ ਇਸ ਵਾਰ ਮੌਸਮ ਥੋੜ੍ਹਾ ਜਿਹਾ ਐਕਸਟੈਂਡ ਹੋ ਗਿਆ ਨ ਨਹੀਂ ਤਾਂ ਨੋਰਮਲੀ ਮਾਰਚ ਤੋਂ ਥੋੜ੍ਹਾ ਜਿਹਾ ਮੌਸਮ ਠੀਕ ਹੋ ਜਾਂਦਾ ਅਤੇ ਮੌਸਮ ਗਰਮੀ ਵਾਲਾ ਹੋ ਜਾਂਦਾ ਹੁੰਦਾ ਇਸ ਵਾਰ ਕੁਛ ਭਵਿੱਖਵਾਣੀਆਂ ਵੀ ਇਸ ਤਰੀਕੇ ਦੀਆਂ ਹੋਈਆਂ ਸੀ ਕਿ ਮੌਸਮ ਜਿਹੜਾ ਥੋੜ੍ਹਾ ਜਿਹਾ ਠੰਡਾ ਹੀ ਰਹੇਗਾ ਪੰਦਰਾਂ ਕੁ ਮਾਰਚ ਤੱਕ ਜਾਂ ਬਸੰਤ ਪੰਚਮੀ ਤੱਕ ਜਿਹੜਾ ਮੌਸਮ ਆ ਨਾ ਉਹ ਇਸ ਤਰੀਕੇ ਦਾ ਰਹਿੰਦਾ ਅਤੇ ਉਸ ਤੋਂ ਬਾਅਦ ਵਿੱਚ ਥੋੜ੍ਹਾ ਜਿਹਾ ਠੀਕ ਹੋ ਜਾਏਗਾ ਅਤੇ ਅੱਗੇ ਹਾਂ ਉਹ ਐਕਚੁਲੀ ਜੇ ਤੁਸੀਂ ਹਾਂ ਹਾਂ ਜਦੋਂ ਵੈਦਰ ਫੋਰਕਾਸਟ ਹੋਇਆ ਸੀ ਕਿ ਬਾਰਿਸ਼ ਹੋਣੀ ਹੈ ਅਤੇ ਚਲੋ ਇਹ ਤਾਂ ਚੱਲਦਾ ਰਹੇਗਾ ਨਹੀਂ ਤਾਂ ਨੋਰਮਲੀ ਅੰਮ੍ਰਿਤਸਰ ਦਾ ਮੌਸਮ ਨਾ ਐਕਸਟ੍ਰੀਮਸ ਤੱਕ ਜਾਂਦਾ ਅਤੇ ਉਹਦੇ ਵਿੱਚ ਜਿੱਦਾਂ ਅਪ੍ਰੈਲ ਤੋਂ ਲੈ ਕੇ ਅਤੇ ਅਕਤੂਬਰ ਤੱਕ ਗਰਮ ਮੌਸਮ ਹੀ ਰਹੇਗਾ ਅਤੇ ਜੂਨ ਜੁਲਾਈ ਦੇ ਮਹੀਨੇ ਬਹੁਤ ਗਰਮ ਹੋਣਗੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਤਾਂ ਪੰਨਤਾਲੀ ਡਿਗਰੀ ਤੋਂ ਪੰਜਾਹ ਡਿਗਰੀ ਤੱਕ ਵੀ ਟੈਂਪਰੇਚਰ ਚਲਾ ਜਾਂਦਾ ਹਾਂਜੀ ਹਾਂਜੀ ਇੱਥੇ ਜੇ ਪੰਜਾਬੀ ਦੇ ਵਿੱਚ ਅਸੀਂ ਕਹੀਏ ਤਾਂ ਜੇਠ ਹਾੜ ਦੇ ਮਹੀਨੇ ਕਹਿੰਦੇ ਨੇ ਅਤੇ ਇਹ ਮਹੀਨੇ ਬਹੁਤ ਚਮਾਖੇ ਵਾਲੇ ਗਰਮੀ ਵਾਲੇ ਕਿਉਂਕਿ ਬਾਹਰ ਫੀਲਡ ਦੇ ਵਿੱਚ ਨਾ ਝੋਨਾ ਲੱਗਾ ਹੁੰਦਾ ਉਹਦੇ ਕਰਕੇ ਥੋੜ੍ਹਾ ਜਿਹਾ ਹਵਾ ਦੇ ਵਿੱਚ ਮੋਇਸਚਰ ਵੀ ਵੱਧ ਜਾਂਦਾ ਉਦੋਂ ਗਰਮੀ ਥੋੜ੍ਹੀ ਜਿਹੀ ਗੰਦੀ ਹੁੰਦੀ ਆ ਹਾਂਜੀ ਅਤੇ ਔਕ ਹਾਂਜੀ ਅਕ ਅਕਤੂਬਰ ਆਨਵਰਡ ਥੋੜ੍ਹਾ ਥੋੜ੍ਹਾ ਮੌਸਮ ਜਿਹੜਾ ਉਹ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਦਸੰਬਰ ਜਨਵਰੀ ਫਰਵਰੀ ਇਹ ਮਹੀਨੇ ਥੋੜ੍ਹੇ ਜਿਹੇ ਠੰਡੇ ਰਹਿੰਦੇ ਨੇ ਅਤੇ ਦਸੰਬਰ ਦੇ ਮਹੀਨੇ 'ਚ ਟੈਂਪਰੇਚਰ ਅੰਮ੍ਰਿਤ ਨਹੀਂ ਨਹੀਂ ਅਜੇ ਤਾਂ ਤੁਸੀਂ ਦੇਖਿਆ ਨਹੀਂ ਕਿਉਂਕਿ ਨਵੀਂ ਨਵੀਂ ਐਡਮਿਸ਼ਨ ਹੋਈ ਨਾ ਤੁਹਾਡੀ ਅਤੇ ਨਵੰਬਰ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਮਾਈਨਸ ਤਿੰਨ ਤੱਕ ਵੀ ਅੰਮ੍ਰਿਤਸਰ ਦਾ ਟੈਂਪਰੇਚਰ ਵੇਖਿਆ ਹੋਇਆ ਅਸੀਂ ਹਾਂਜੀ ਅਜੇ ਤਾਂ ਛ ਪੱਚੀ ਛੱਬੀ ਡਿਗਰੀ ਟੈਂਪਰੇਚਰ ਨੂੰ ਤੁਸੀਂ ਜੇ ਕਹੋਗੇ ਠੀਕ ਮੌਸਮ ਤਾਂ ਉਦੋਂ ਦਾ ਐਕਸਟ੍ਰੀਮਸ ਆਉਣਗੀਆਂ ਅਤੇ ਬਾਕੀ ਕੋਈ ਨਹੀਂ ਹੌਲੀ ਹੌਲੀ ਤੁਹਾਨੂੰ ਇੱਥੇ ਰਹੋਗੇ ਆਦਤ ਪੈ ਜਾਵੇਗੀ ਮੌਸਮ ਬਹੁਤ ਵਧੀਆ ਅੰਮ੍ਰਿਤਸਰ ਦਾ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਜੀ